ਆਮ ਤੌਰ 'ਤੇ ਅਸੀਂ ਦੇਖ ਰਹੇ ਹਾਂ ਕਿ ਸਾਡੇ ਇਲਾਕੇ ਦੇ ਵਿੱਚ ਅਪਰਾਧ ਦਿਨ ਤੋਂ ਦਿਨ ਵੱਧ ਹੀ ਰਹੇ ਹਨ ਜੇਕਰ ਅਸੀਂ ਦੇਖਣ ਜਾਈਏ ਤਾਂ ਗਰੀਬੀ ਅਤੇ ਬੇਰੁਜ਼ਗਾਰੀ ਦੋਵੇਂ ਹੀ ਇਸਦੇ ਮੁੱਖ ਕਾਰਨ ਮੰਨੇ ਜਾਂਦੇ ਹਨ ਜੋ ਇਨਸਾਨ ਗਰੀਬ ਹੁੰਦਾ ਹੈ ਉਹ ਆਪਣੇ ਢਿੱਡ ਦੀ ਭੁੱਖ ਨੂੰ ਪੂਰਾ ਕਰਨ ਦੇ ਲਈ ਇੱਧਰ ਉੱਧਰ ਲੁੱਟ ਖਸੁੱਟ ਕਰਦਾ ਫਿਰਦਾ ਹੈ ਰਾਹ ਜਾਂਦੇ ਲੋਕਾਂ ਦੀਆਂ ਚੋਰੀਆਂ ਕਰਨ ਲੱਗ ਜਾਂਦਾ ਹੈ ਜਿਸ ਤਰ੍ਹਾਂ ਕਿ ਕਈ ਵਾਰ ਜੋ ਕਿ ਔਰਤਾਂ ਸੋਨੇ ਦੇ ਗਹਿਣੇ ਪਾਈ ਜਾ ਰਹੀਆਂ ਹੁੰਦੀਆਂ ਹਨ ਉਹਨਾਂ ਦੇ ਗਹਿਣ ਗਹਿਣੇ ਖਿੱਚ ਕੇ ਚੋਰੀ ਕਰਕੇ ਲੈ ਜਾਂਦੇ ਹਨ ਅਤੇ ਜੋ ਵੀ ਲੋਕ ਬੇਰੁਜ਼ਗਾਰ ਹੁੰਦੇ ਹਨ ਉਹ ਬੇਰੁਜ਼ਗਾਰੀ ਦੇ ਚਲਦੇ ਹੋਏ ਇੱਕ ਦੂਸਰੇ ਦੇ ਨਾਲ ਗਲਤ ਕਰਨ ਬਾਰੇ ਸੋਚਦੇ ਹਨ ਜਿਸ ਕਰਕੇ ਕੁੜੀਆਂ ਦੇ ਲਈ ਬਾਹਰ ਆਉਣਾ ਜਾਣਾ ਬੱਸ ਦੇ ਵਿੱਚ ਐਨਾ ਮੁਸ਼ਕਲ ਹੋ ਰਿਹਾ ਹੈ ਕਿ ਉਹਨਾਂ ਨੂੰ ਬਿਲਕੁਲ ਵੀ ਸੁਰੱਖਿਅਤ ਨਹੀਂ ਮਹਿਸੂਸ ਹੁੰਦਾ ਜਦੋਂ ਵੀ ਆਪਣੇ ਘਰ ਤੋਂ ਬਾਹਰ ਕਿਤੇ ਜਾਣ ਲੱਗ ਜਾਂਦੀਆਂ ਹਨ ਬੇਰੁਜ਼ਗਾਰੀ ਦੇ ਹੁੰਦਿਆਂ ਕਈ ਲੋਕ ਗਲਤ ਕੰਮਾਂ ਨਾਲ ਵੀ ਪੈਸੇ ਕਮਾਉਣ ਲੱਗ ਪੈਂਦੇ ਹਨ ਅਤੇ ਇਸ ਤਰ੍ਹਾਂ ਨਾਲ ਕਈ ਤਰ੍ਹਾਂ ਦੇ ਘੋਰ ਅਪਰਾਧ ਕਰਨ ਲੱਗ ਜਾਂਦੇ ਹਨ ਜਿਨ੍ਹਾਂ ਨਾਲ ਉਨਾਂ ਦੀ ਆਪਣੀ ਜਾਨ ਤਾਂ ਮੁਸ਼ਕਲ ਦੇ ਵਿੱਚ ਆਉਂਦੀ ਹੀ ਆਉਂਦੀ ਹੈ ਅਤੇ ਜੋ ਕਿ ਇਸ ਸਾਰੇ ਕਿੱਸੇ ਦੇ ਵਿੱਚ ਪ੍ਰਭਾਵਿਤ ਹੋਣ ਵਾਲੇ ਇਹਨਾਂ ਦੇ ਸ਼ਿਕਾਰੀ ਹੁੰਦੇ ਹਨ ਉਹਨਾਂ ਦੀਆਂ ਵੀ ਜ਼ਿੰਦਗੀਆਂ ਤਬਾਹ ਹੋ ਜਾਂਦੀਆਂ ਹਨ ਸਾਨੂੰ ਚਾਹੀਦਾ ਹੈ ਕਿ ਅਸੀਂ ਗਰੀਬੀ ਅਤੇ ਬੇਰੁਜ਼ਗਾਰੀ ਦੇ ਜੋ ਵੱਧਦੇ ਮੁਸ਼ਕਲ ਹੈ ਇਸ ਨੂੰ ਨਕੇਲ ਪਾਈ ਜਾਵੇ ਅਤੇ ਇਹਦੀਆਂ ਜੋ ਵੀ ਸਮੱਸਿਆ ਨੇ ਉਹਨਾਂ ਨੂੰ ਹੱਲ ਕੀਤਾ ਜਾਵੇ